ਸਤਿ ਸ਼੍ਰੀ ਅਕਾਲ ਜੀ ਮੈਂ ਪੰਜਾਵਾ ਪਿੰਡ ਤੋਂ ਗੱਲ ਕਰ ਰਹੀ ਹਾਂ ਮੈਂ ਤੁਹਾਡੇ ਐਮਾਜ਼ੋਨ ਤੋਂ ਹਮੇਸ਼ਾਂ ਪ੍ਰੋਡਕਟ ਖਰੀਦਦੀ ਰਹਿੰਦੀ ਹਾਂ ਅਤੇ ਮੈਂ ਇਸ ਵਾਰ ਬੈਡਸ਼ੀਟ ਮੰਗਵਾਈ ਸੀ ਜੋ ਕਿ ਖਰਾਬ ਨਿਕਲ ਗਈ ਹੈ ਉਸ ਦਿਨ ਹੀ ਸਾਡੇ ਮਹਿਮਾਨਾਂ ਨੇ ਆਉਣਾ ਸੀ ਮੈਨੂੰ ਇਸ ਗੱਲ ਨਾਲ ਬਹੁਤ ਨਿਰਾਸ਼ਾ ਹੈ ਕਿ ਮੈਂ ਇਹ ਬੈਡਸ਼ੀਟ ਬਹੁਤ ਹੀ ਰੀਝ ਨਾਲ ਮੰਗਵਾਈ ਸੀ ਸਾਡੇ ਇਸ ਦਿਨ ਹੀ ਮਹਿਮਾਨ ਆਉਣੇ ਸਨ ਪਰ ਇਹ ਬੈਡਸ਼ੀਟ ਜਦੋਂ ਮੈਂ ਖੋਲ੍ਹੀ ਤਾਂ ਵਿੱਚੋਂ ਬਿਲਕੁਲ ਫਟੀ ਹੋਈ ਸੀ